ਨਮਸਕਾਰ ਸਰ ਨਮਸਕਾਰ ਸਰ ਹਾਂਜੀ ਸਰ ਹਾਂਜੀ ਗੁਰਦਾਸਪੁਰ ਤੋਂ ਕਿਹੜੀ ਕਿਹੜੀ ਟਰੇਨ ਜਾਂਦੀ ਹੈ ਇਹ ਪੁੱਛਣਾ ਚਾਹੁੰਦੇ ਹੋ ਠੀਕ ਹੈ ਸਰ ਗੁਰਦਾਸਪੁਰ ਤੋਂ ਵੈਸੇ ਟਰੇਨ ਜਾਂਦੀ ਹੈ ਇੱਧਰ ਜੰਮੂ ਲਈ ਵੀ ਜਾਂਦੀ ਹੈ ਕਟਰਾ ਜਾਂਦੀ ਹੈ ਉਦਮਪੁਰ ਜਾਂਦੀ ਹੈ ਹੋਰ ਫਿਰ ਪਠਾਨਕੋਟ ਤੱਕ ਜਾਂਦੀ ਹੈ ਪਠਾਨਕੋਟ ਤੋਂ ਤੁਸੀਂ ਟਰੇਨ ਚੇਂਜ ਕਰਕੇ ਹਿਮਾਚਲ ਵੀ ਜਾ ਸਕਦੇ ਹੋ ਹਿਮਾਚਲ ਵੀ ਜਾਂਦੀ ਹੈ ਉੱਦਾਂ ਟਰੇਨ ਹੋਰ ਉਸ ਤੋਂ ਇਲਾਵਾ ਗੁਰਦਾਸਪੁਰ ਤੋਂ ਦਿੱਲੀ ਵੀ ਜਾਂਦੀ ਹੈ ਟਰੇਨ ਅੰਮ੍ਰਿਤਸਰ ਹੋਰ ਜਲੰਧਰ ਵਾਲੀ ਸਾਈਡ ਵੀ ਜਾਂਦੀ ਹੈ ਹਾਂਜੀ ਹਾਂਜੀ ਸਰ ਸਾਰੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਹਰ ਟਰੇਨ ਦੀ ਟਿਕਟ ਜਿਹੜੀ ਹੈ ਔਨਲਾਈਨ ਹੋ ਜਾਂਦੀ ਹੈ ਜੇ ਤਾਂ ਤੁਸੀਂ ਮਤਲਬ ਕਿ ਤਤਕਾਲ ਵਿੱਚ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਇੱਕ ਦਿਨ ਪਹਿਲਾਂ ਹੁੰਦੀ ਹੈ ਔਰ ਜੇ ਤੁਸੀਂ ਮਤਲਬ ਕਿ ਮਹੀਨਾ ਇੱਕ ਤੁਹਾਡੇ ਕੋਲ ਟਾਈਮ ਹੈ ਤੁਸੀਂ ਇੱਕ ਮਹੀਨੇ ਬਾਅਦ ਜਾਣਾ ਹੈ ਅਤੇ ਉਹ ਤੁਸੀਂ ਜਨਰਲ 'ਚ ਵੀ ਕਰ ਸਕਦੇ ਹੋ ਫਿਰ ਹਾਂਜੀ ਸਰ ਗੁਰਦਾਸਪੁਰ ਦਾ ਸਟੇਸ਼ਨ ਹੁਣ ਬੜਾ ਸੋਹਣਾ ਬਣ ਗਿਆ ਸਾਫ ਸੁਥਰਾ ਬਿਲਕੁਲ ਹਾਂਜੀ ਸਰ ਸਭ ਸਭ ਕੁਝ ਮਿਲੇਗਾ ਤੁਹਾਨੂੰ ਸਟੇਸ਼ਨ ਦੇ ਬਾਹਰ ਜੇ ਤੁਹਾਨੂੰ ਕੋਈ ਵੀ ਜ਼ਰੂਰਤ ਦੀ ਚੀਜ਼ ਚਾਹੀਦੀ ਹੈ ਉਹ ਮਿਲ ਜਾਏਗੀ ਸਰ ਤੁਹਾਨੂੰ ਸਟੇਸ਼ਨ ਤੋਂ ਨਾਲੇ ਬਾਹਰ ਮਾਰਕੀਟ ਹੈ ਪੂਰੀ ਸਿਰਫ ਸੌ ਮੀਟਰ ਦੀ ਦੂਰੀ 'ਤੇ ਹੀ ਹੈ ਮਾਰਕੀਟ ਹੈ ਪੂਰਾ ਅੱਗੇ ਬੱਸ ਸਟੈਂਡ ਵੀ ਲਾਗੇ ਹੀ ਹੈ ਸਟੇਸ਼ਨ ਤੋਂ ਤੁਹਾਨੂੰ ਹਰ ਫੈਸਿਲਿਟੀ ਮਿਲ ਜੇਗੀ ਵੈਲਕਮ ਸਰ